ਪੰਜਾਬ ਦੀ ਉੱਨਤੀ ਲਈ ਅਤੇ ਹੋਰ ਮਸਲਿਆਂ ਲਈ ਰਾਜ ਸਰਕਾਰ ਆਪਣੇ ਮੌਜੂਦਾ ਮੰਤਰੀਆਂ ਨਾਲ਼ ਮਿਲ ਕੇ ਇਹਨਾਂ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਕਰਦੀ ਹੈ ਸਭ ਦੀ ਸਹਿਮਤੀ ਹੋਣ ਉਪਰੰਤ ਫੈਸਲੇ ਲਏ ਜਾਂਦੇ ਹਨ ਇਹ ਫੈਸਲੇ ਜਾਂ ਕਾਨੂੰਨ ਲੋਕਾਂ ਦੀ ਰਾਖੀ ਅਤੇ ਹਿੱਤ ਲਈ ਕੀਤੇ ਜਾਂਦੇ ਹਨ ਇਹਨਾਂ ਸਾਰੇ ਫੈਸਲਿਆਂ ਅਤੇ ਕਾਨੂੰਨ ਲਾਗੂ ਕਰਵਾਉਣ ਲਈ ਰਾਜ ਦੇ ਰਾਜਪਾਲ ਪਾਸ ਪੇਸ਼ ਕੀਤੇ ਜਾਂਦੇ ਹਨ ਉੱਥੇ ਦੇ ਹੀ ਇਹ ਲਾਗੂ ਹੁੰਦੇ ਹਨ